ਛੋਟੇ ਹੁੰਦਿਆਂ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਕਿ ਮੈਂ ਕਾਗਜ਼ ਦਾ ਕਦੀ ਕੁਛ ਬਣਾਵਾਂ ਕਦੇ ਕੁਛ ਬਣਾਵਾਂ ਕਦੇ ਕਦੇ ਮੈਂ ਕਾਗਜ਼ ਦੇ ਉੱਤੇ ਜਾਂ ਆਪਣੇ ਪੇਜ਼ ਦੇ ਉੱਤੇ ਵਾਈਟ ਪੇਜ਼ ਦੇ ਉੱਤੇ ਗੁੱਡੀਆਂ ਜਾਂ ਫਿਰ ਕੋਈ ਹੋਰ ਡਰਾਇੰਗ ਕਰਦੀ ਰਹਿੰਦੀ ਸੀ ਬਟ ਇੱਕ ਦਿਨ ਐਵੇਂ ਹੀ ਸਾਡੇ ਕ ਸਕੂਲ ਵਿੱਚ ਜਦੋਂ ਸਾਡੀ ਮੈ ਟੀਚਰ ਨੇ ਸਾਨੂੰ ਗੁੱਡੀਆਂ ਬਣਾ ਕੇ ਦਿੱਤੀਆਂ ਤਾਂ ਮੈਨੂੰ ਉਹਨਾਂ ਦੀ ਉਹਨਾਂ ਦੀ ਗੁੱਡੀਆਂ ਵੱਲ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਅਤੇ ਮੈਨੂੰ ਇੱਕ ਮੇਰੇ ਮਨ ਵਿੱਚ ਸਿੱਖਣ ਦੀ ਇੱਛਾ ਪੈਦਾ ਹੋ ਗਈ ਕਿ ਮੈਨੂੰ ਵੀ ਗੁੱਡੀਆਂ ਬਣਾਉਣਾ ਸਿੱਖਣਾ ਹੈ ਅਤੇ ਫਿਰ ਮੇਰੇ ਜਿਹੜੇ ਟੀਚਰ ਆ ਸਕੂਲ ਦੇ ਉਹਨਾਂ ਨੇ ਮੈਨੂੰ ਗੁੱਡੀਆਂ ਬਣਾਉਣਾ ਸਿਖਾਇਆ ਜਿਹਦੇ ਵਿੱਚ ਮੇਰਾ ਬਹੁਤ ਹੀ ਦਿਲ ਲੱਗਿਆ ਅਤੇ ਮੈਂ ਉਹਨਾਂ ਨੂੰ ਪੂਰੇ ਦਿਲ ਦੇ ਨਾਲ ਸਿੱਖਿਆ ਜਿਸ ਵਿੱਚ ਮੈਨੂੰ ਬਹੁਤ ਹੀ ਘੱਟ ਸਮੇਂ ਵਿੱਚ ਮੈਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਸਿਖਾਈਆਂ ਗਈਆਂ ਗੁੱਡੀਆਂ ਬਣਾਉਣੀਆਂ ਸਿੱਖ ਲਈਆਂ ਸੀਗੀਆਂ ਅਤੇ ਐਂਵੇ ਇ ਜਿਵੇਂ ਮੀਂਹ ਵਿੱਚ ਛੋਟੇ ਬੱਚੇ ਕਿਸ਼ਤੀਆਂ ਬਣਾਉਂਦੇ ਹਨ ਉਹ ਵੀ ਮੈਂ ਆਪਣੇ ਜਿਹੜੇ ਕਲਾਸ ਟੀਚਰ ਸੀਗੇ ਉਹਨਾਂ ਤੋਂ ਮੈਂ ਉਹ ਵੀ ਸਿੱਖੀਆਂ ਅਤੇ ਮੇਰੇ ਟੀਚਰ ਨੇ ਮੈਨੂੰ ਉਹ ਵੀ ਸਿਖਾਈਆਂ ਜਦੋਂ ਵੀ ਕਿਤੇ ਬਾਰਿਸ਼ ਹੁੰਦੀ ਸੀਗੀ ਤਾਂ ਫਿਰ ਜਿਹੜੇ ਬਾਰਿਸ਼ ਤੋਂ ਬਾਅਦ ਜਿਹੜੀਆਂ ਛੱਪੜੀਆਂ ਜਾਂ ਜਿਹਨਾਂ ਨੂੰ ਆਪਾਂ ਇੰਗਲਿਸ਼ 'ਚ ਪਡਲਸ ਕਹਿ ਦਿੰਦੇ ਹਾਂ ਉਹ ਹੁੰਦੇ ਸੀਗੇ ਤਾਂ ਮੈਂ ਫਿਰ ਉਹਨਾਂ ਦੇ ਉੱਤੇ ਕਿਸ਼ਤੀਆਂ ਬਣਾ ਬਣਾ ਕੇ ਆਪਣਾ ਮਤਲਬ ਕਿ ਉਹਨਾਂ ਦੇ ਵਿੱਚ ਚਲਾ ਕੇ ਬਹੁਤ ਹੀ ਵਧੀਆ ਖੁਸ਼ ਹੁੰਦੀ ਸੀਗੀ ਅਤੇ ਉਹਨਾਂ ਨੂੰ ਦੇਖ ਦੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਸੀ